ਦੇਖੋ ਜੀ ਗੱਲ ਹੈਗੀ ਹੈ ਇੱਦਾਂ ਪੇਂਡੂ ਅਤੇ ਸ਼ਹਿਰਾਂ ਵਾਲ਼ੇ ਖੇ ਖੇਡਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਹੈ ਜੀ ਜੋ ਕਿ ਸ਼ਹਿਰਾਂ ਵਾਲ਼ੇ ਬੱਚੇ ਹੈ ਉਹ ਜਿਵੇਂ ਕਿ ਇੰਨਡੌਰ ਗੇਮਜ਼ ਪਸੰਦ ਕਰਦੇ ਨੇ ਘਰ 'ਚ ਬੈਠੇ ਹੀ ਵੀਡਿਓ ਗੇਮ ਹੋ ਗਈ ਜਿਵੇਂ ਲੂਡੋ ਹੋ ਗਈ ਉਹ ਜ਼ਿਆਦਾਤਰ ਇਹ ਗੇਮਾਂ ਨੂੰ ਟਾਈਮ ਦਿੰਦੇ ਨੇ ਜੋ ਪਿੰਡਾਂ ਵਾਲ਼ੇ ਹੁੰਦੇ ਜੀ ਆਪਣੇ ਉਹ ਫਿਰ ਦੇਸੀ ਤਰੀਕੇ ਨਾਲ਼ ਜਿਵੇਂ ਕਿ ਜੀ ਕਬੱਡੀ ਹੋ ਗਈ ਫੁੱਟਵਾਲ ਹੋ ਗਈ ਇਹ ਚੀਜ਼ਾਂ ਨੂੰ ਆਊਟਡੋਰ 'ਚ ਜ਼ਿਆਦਾ ਖੇਲਣਾ ਪਸੰਦ ਕਰਦੇ ਨੇ ਜਿਵੇਂ ਕਿ ਪਿੰਡਾਂ 'ਚ ਖੋ ਖੋ ਹੋ ਗਈ ਅਤੇ ਹੋਰ ਰਨਿੰਗ ਵਗੈਰਾ ਵੀ ਮੁੰਡੇ ਕਰਦੇ ਨੇ ਬਹੁਤ ਹੀ ਗੁੱਲੀ ਡੰਡਾ ਹੋ ਗਿਆ ਜੀ ਬਹੁਤ ਹੀ ਜੋ ਕਿ ਪੁਰਾਤਨ ਖੇਡਾਂ ਏ ਸਾਡੇ ਪੰਜਾਬ ਦੀਆਂ ਇਹ ਸਿਰਫ਼ ਪੰਜਾਬ 'ਚ ਏ ਤੁਹਾਨੂੰ ਦੇਖਣ ਨੂੰ ਮਿਲਨੀਆਂ ਜੀ ਪੰਜਾਬ ਤੋਂ ਬਾਹਰ ਜਾਊਂਗੇ ਤੁਹਾਨੂੰ ਇਹੇ ਜਿਹੀ ਚੀਜ਼ ਕਿਤੇ ਨਹੀਂ ਮਿਲਣੀ ਉੱਥੇ ਤੁਹਾਨੂੰ ਕ੍ਰਿਕਟ ਹੋ ਗਈ ਵਾਲੀਵਾਲ ਹੋ ਗਈ ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ ਜੋ ਕਿ ਪੰਜਾਬ ਦੀਆਂ ਮਹਾਨ ਖੇਡਾਂ ਜਿਵੇਂ ਕਿ ਗੁੱਲੀ ਡੰਡਾ ਖੋ ਖੋ ਕਬੱਡੀ ਇਹ ਚੀਜ਼ਾਂ ਸਿਰਫ਼ ਤੁਹਾਨੂੰ ਪੰਜਾਬ 'ਚ ਏ ਮਿਲਣਗੀਆਂ ਜੀ ਜੇ ਕਿਤੇ ਬਾਹਰ ਜਾਊਂਗੇ ਨਹੀਂ ਮਿਲਣੀਆਂ ਜੋ ਕਿ ਸ਼ਹਿਰਾਂ ਵਾਲ਼ੇ ਬੱਚੇ ਆਂ ਜਿਵੇਂ ਕਿ ਜ਼ਿਆਦਾਤਰ ਇਲੈਕਟ੍ਰੋਨਿਕ ਚੀਜ਼ਾਂ ਪਰ ਡੀਪੈਂਡ ਹੁੰਦੇ ਜੀ ਉਹ ਜਿਵੇਂ ਕਿ ਲੂਡੋ ਹੋ ਗਈ ਵੀਡਿਓ ਗੇਮਜ਼ ਹੋ ਗਈ ਪਲੇਅ ਸਟੇਸ਼ਨ ਹੋ ਗਈ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਪ੍ਰੈਫ਼ਰ ਕਰਦੇ ਹੈ ਜਿਵੇਂ ਕਿ ਟੈਕਨੋਲਜੀ ਦੇ ਨਾਲ਼ ਨਾਲ਼ ਅੱਜ ਕੱਲ੍ਹ ਲੇਟੈਸਟ ਗੇਮਾਂ ਆ ਰਹੀਆਂ ਏ ਜਿਵੇਂ ਕਿ ਪਲੇਅ ਸਟੇਸ਼ਨ ਥਰੀ ਹੋ ਗਈ ਬੱਚੇ ਜ਼ਿਆਦਾਤਰ ਉਸ ਚੀਜ਼ ਨੂੰ ਪ੍ਰੈਫਰੈਂਸ ਕਰਦੇ ਨੇ ਜਿਵੇਂ ਕਿ ਉਸ ਨਾਲ਼ ਇੱਕ ਤਾਂ ਵੇਸਟੇਜ ਆਫ ਮਨੀ ਹੈ ਨੰਬਰ ਦੋ ਅਤੇ ਉਹ ਆਪਣੇ ਸਰੀਰ ਦੀ ਫਿੱਟਨੈੱਸ ਨਹੀਂ ਰੱਖ ਪਾਉਂਦੇ ਉਸ ਚੀਜ਼ ਨਾਲ਼ ਫਿੱਟਨੈੱਸ ਦੇ ਰੀਲੇਟਿਡ ਇਸ ਕਰਕੇ ਜ਼ਿਆਦਾ ਬਿਮਾਰ ਹੋ ਜਾਂਦੇ ਹੈ ਉਹ ਅਤੇ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਕਿ ਪਿੰਡਾਂ ਵਾਲੇ ਬੱਚੇ ਹੈ ਜੀ ਉਹ ਜਿਵੇਂ ਆਊਟਡੋਰ ਐਕਟੀਵੀਟੀ ਕਰਦੇ ਹੈ ਜਿਵੇਂ ਕਿ ਕਬੱਡੀ ਲੁੱਕਣ ਮਚੀਚਾ ਹੋ ਗਿਆ ਇਹਨਾਂ ਚੀਜ਼ਾਂ ਕਰਕੇ ਉਹ ਫਿੱਟ ਵੀ ਰਹਿੰਦੇ ਹੈ ਅਤੇ ਬਿਮਾਰੀਆਂ ਤੋਂ ਵੀ ਬਹੁਤ ਦੂਰ ਰਹਿੰਦੇ ਹੈ ਥੈਂਕ ਯੂ ਜੀ ਧੰਨਵਾਦ